ਮੈਨੂੰ ਨਾ ਖਾਣੇ ਬਣਾਉਣੇ ਤਾਂ ਬਹੁਤ ਪਸੰਦ ਆ ਉਹ ਮੈਂ ਬਣਾ ਵੀ ਲੈਂਦੀ ਹਾਂ ਮਤਲਬ ਮੈਂ ਅ ਤਰ੍ਹਾਂ ਤਰ੍ਹਾਂ ਦੇ ਜਿੱਦਾਂ ਰਾਜਮਾਂਹ ਚਾਵਲ ਹੋ ਗਏ ਜਾਂ ਅ ਚਨੇ ਬਲੈਕ ਚਨੇ ਹੋ ਗਏ ਕਾਲੇ ਚਨੇ ਜਾਂ ਕਾਬਲੀ ਚਨੇ ਹੋ ਗਏ ਜਾਂ ਮਤਲਬ ਕਾਲੇ ਚਨੇ ਪੂੜੀ ਹੋ ਗਈ ਕੜੀ ਚਾਵਲ ਹੋ ਗਏ ਜਾਂ ਮਤਲਬ ਜੇ ਜਿਹੜੀਆਂ ਅਹ ਪਨੀਰ ਹੋ ਗਿਆ ਸ਼ਾਹੀ ਪਨੀਰ ਹੋ ਗਿਆ ਅਤੇ ਮਿਕਸ ਵੈਜ ਹੋ ਗਈ ਮੈਂ ਬਣਾ ਲੈਂਦੀ ਹਾਂ ਪਰ ਇਹਨਾਂ ਸਭ ਦੇ ਵਿੱਚ ਜਿਹੜਾ ਨਾ ਮਤਲਬ ਮੈਂ ਨਾ ਸਾਗ ਬਣਾਉਣਾ ਜਿਹੜਾ ਹੈ ਉਹ ਵਧੀਆ ਤਾਂ ਲੱਗਦਾ ਹੈ ਪਰ ਬਣਾਉਣਾ ਬਣਾਉਣ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗਦਾ ਹੈ ਇਸ ਕਰਕੇ ਥੋੜ੍ਹਾ ਲੱਗਦਾ ਕਿ ਔਖਾ ਹੈ ਔਖਾ ਨਹੀਂ ਹੈ ਬਟ ਇਹ ਕਿ ਥੋੜ੍ਹਾ ਟਾਈਮ ਬਹੁਤ ਲੈਂਦਾ ਇਹ ਕਿਉਂਕਿ ਜਦੋਂ ਸਾਗ ਲਿਆਉਣਾ ਆ ਹੈ ਨਾ ਸਾਗ ਲਿਆਉਣਾ ਫਿਰ ਉਹਨੂੰ ਸਾਫ਼ ਕਰਨਾ ਹੈ ਫਿਰ ਉਹਨੂੰ ਧੋਣਾ ਹੈ ਧੋ ਕੇ ਫਿਰ ਉਹਨੂੰ ਸਾਫ਼ ਕਰੋ ਫਿਰ ਉਸ ਉਸਦੇ ਵਿੱਚ ਮਤਲਬ ਤੁਸੀਂ ਕਿੰਨੀਆਂ ਚੀਜ਼ਾਂ ਪਾਓ ਮਤਲਬ ਮੇਥੇ ਪਾ ਲਓ ਮੈਂ ਮੇਥੀ ਪਾ ਲਓ ਪਾਲਕ ਪਾ ਲਓ ਬਾਥੂ ਪਾ ਲਓ ਮਤਲਬ ਇਹ ਹੈਗਾ ਅਤੇ ਉਹਦਾ ਪ੍ਰੋਸੈਸ ਜਿਹੜਾ ਕੁਝ ਦਾ ਫਿਰ ਉਸਨੂੰ ਕੱਟਣਾ ਪੈਂਦਾ ਹੈ ਫਿਰ ਕੱਟ ਕੇ ਉਹਨੂੰ ਜਿਹੜਾ ਹੈ ਧਰਨਾ ਪੈਂਦਾ ਹੈ ਜਦੋਂ ਬਣ ਜਾਂਦਾ ਹੈ ਮਤਲਬ ਬਣ ਜਾਂਦਾ ਫਿਰ ਉਸਨੂੰ ਅ ਜਦੋਂ ਮਤਲਬ ਘੋਟਣਾ ਵੀ ਪੈਂਦਾ ਹੈ ਔਰ ਘੋਟਣੇ ਦੇ ਨਾਲ ਉਹ ਜਿਹੜਾ ਘੋਟਣ ਵਾਲਾ ਕੰਮ ਹੈ ਉਹ ਬਹੁਤ ਹੀ ਔਖਾ ਹੁੰਦਾ ਮਤਲਬ ਕਿ ਉਹਦੇ ਨਾਲ ਕਿਉਂਕਿ ਉਹਨੂੰ ਬਿਲਕੁਲ ਹੀ ਮਿਕਸ ਕਰਨਾ ਹੁੰਦਾ ਹੈ ਹੈ ਨਾ ਇਹਦਾ ਮਤਲਬ ਪੱਤੇ ਪੱਤੇ ਜਿਹੇ ਨਾ ਰਹਿਣ ਔਰ ਉਹਨੂੰ ਕਹਿੰਦੇ ਨਾ ਅੱਜ ਕੱਲ੍ਹ ਪੰਜਾਬੀਆਂ ਦੇ ਵਿੱਚ ਮਸ਼ਹੂਰ ਹੈ ਕਿ ਮਲਾਈ ਵਰਗਾ ਸਾਗ ਅਤੇ ਉਹੋ ਜਿਹਾ ਬਣਾਉਣਾ ਹੁੰਦਾ ਹੈ ਅਤੇ ਉਹਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮਤਲਬ ਫਿਰ ਮੱਕੀ ਦਾ ਆਟਾ ਪਾ ਕੇ ਰਲਾਓ ਫਿਰ ਉਹਨੂੰ ਘੋਟੋ ਕਿੰਨਾ ਹੀ ਟਾਈਮ ਲੱਗ ਜਾਂਦਾ ਹੈ ਪਰ ਇਹ ਹੈ ਕਿ ਅੰਤ ਦੇ ਵਿੱਚ ਜਿਹੜਾ ਆ ਮਤਲਬ ਉਹ ਬਣਦਾ ਬਹੁਤ ਸਵਾਦ ਹੈ ਪਰ ਪ੍ਰੋਸੈਸ ਥੋੜ੍ਹਾ ਜਿਹਾ ਔਖਾ ਹੈ